ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਹਰਪ੍ਰੀਤ ਸਿੰਘ ਗੱਲ ਕਰ ਰਿਹਾ ਜੀ ਤੁਸੀਂ ਝੱਜ ਟਰੈਵਲ ਏਜੰਸੀ ਤੋਂ ਗੱਲ ਕਰ ਰਹੇ ਹਾਂਜੀ ਕੱਲ੍ਹ ਸਰ ਮੈਂ ਤੁਹਾਡੇ ਇੱਕ ਕੈਬ ਬੁੱਕ ਕਰਵਾਈ ਸੀ ਅੰਮ੍ਰਿਤਸਰ ਜਾਣ ਵਾਸਤੇ ਅਤੇ ਕੁਝ ਮੈਨੂੰ ਐਮਰਜੈਂਸੀ ਹੋ ਗਈ ਇੱਧਰ ਘਰ ਦੇ ਵਿੱਚ ਜਿਸ ਕਰਕੇ ਮੈਂ ਤੁਹਾਡੀ ਕੈਬ ਦੀ ਜਿਹੜੀ ਬੁਕਿੰਗ ਉਹ ਕੈਂਸਲ ਕਰਵਾਉਣਾ ਚਾਹੁੰਦਾ ਸੀ ਅਤੇ ਮੈਂ ਕੋ ਐਡਵਾਂਸ ਦੇ ਵਿੱਚ ਤੁਹਾਨੂੰ ਕੁਝ ਪੇਮੈਂਟ ਕੀਤੀ ਸੀ ਪੰਜ ਸੌ ਕੁ ਰੁਪਈਆ ਮੈਂ ਚਾਹੁੰਦਾ ਸੀ ਵੀ ਉਹ ਮੇਰੇ ਤੁਸੀਂ ਰਿਫੰਡ ਕਰ ਦਿਉ ਅਤੇ ਇਨ ਫਿਊਚਰ ਅਗਰ ਕਿਤੇ ਮੈਨੂੰ ਟਰੈਵਲ 'ਤੇ ਮੈਂ ਜਾਣਾ ਹੋਊਗਾ ਤਾਂ ਤੁਹਾਡੀ ਕੈਬ ਮੈਂ ਬੁੱਕ ਕਰਵਾਉਂਗਾ ਜੀ ਅਤੇ ਕਿਰਪਾ ਕਰਕੇ ਜਲਦੀ ਤੋਂ ਜਲਦੀ ਜਿਹੜੀ ਪੇਮੈਂਟ ਮੇਰੀ ਰਿਫੰਡ ਕਰ ਦਿਉ ਜੀ ਸਤਿ ਸ਼੍ਰੀ ਅਕਾਲ ਜੀ